ਪੰਜਾਬੀ ਸਾਡੀ ਮਾਂ ਬੋਲੀ ਹੈ ਅਸੀਂ ਸਭ ਤੋਂ ਪਹਿਲਾਂ ਬੋਲੀ ਆਪਣੇ ਪਰਿਵਾਰ ਅਤੇ ਆਪਣੀ ਮਾਂ ਤੋਂ ਸਿੱਖੀ ਉਸ ਤੋਂ ਬਾਅਦ ਅਸੀਂ ਆਪਣੇ ਸਕੂਲ ਤੋਂ ਸਿੱਖੀ ਸਕੂਲ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਕੂਲ ਵਿੱਚ ਵੱਖ ਵੱਖ ਧਰਮਾਂ ਦੇ ਬੱਚਿਆਂ ਤੋਂ ਕਈ ਸ਼ਬਦ ਸਿੱਖਣ ਨੂੰ ਮਿਲੇ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਪੰਜਾਬੀ ਭਾਸ਼ਾ 'ਚ ਸਾਨੂੰ ਕਈ ਲਗਾਂ ਮਾਤਰਾ ਬਾਰੇ ਪਤਾ ਲੱਗਿਆ